ਭੰਗੜੇ ਦੇ ਪ੍ਰਦਰਸ਼ਨ ਲਈ ਆਮ ਤੌਰ 'ਤੇ ਪੰਜਾਬੀਆਂ ਦਾ ਆਪਣਾ ਹੀ ਪਰਾ ਪਹਿਰਾਵਾ ਹੁੰਦਾ ਹੈ ਜਿਵੇਂ ਕਿ ਕੁੜਤਾ ਪਜਾਮਾ ਪੱਗ ਬੰਨਣੀ ਜੁ ਪੰਜਾਬੀ ਜੁੱਤੀ ਪਾਉਣੀ ਕੁੜੀਆਂ ਦਾ ਵੀ ਆਪਣਾ ਵੱਖਰਾ ਪਹਿਰਾਵਾ ਹੁੰਦਾ ਜਿਵੇਂ ਕਿ ਪੰਜਾਬੀ ਸੂਟ ਪਾਉਣੇ ਪੰਜਾਬੀ ਜੁੱਤੀ ਪਾਉਣੀ ਗੁੱਤ 'ਚ ਪਰਾਂਦਾ ਪਾਉਣਾ ਅਤੇ ਇਹਨਾਂ ਨੂੰ ਹੋਰ ਵੀ ਵਧੀਆ ਕਰ ਸਕਦੇ ਹਾਂ ਜਿਵੇਂ ਕਿ ਗਲ ਵਿੱਚ ਮਤਲਬ ਗਹਿਣੇ ਪਾਉਣੇ ਮੁੰਡਿਆਂ ਦੇ ਕੈਂਠਾ ਪਾਉਣਾ ਢੋਲ ਵਜਾਉਣਾ ਆਪਣਾ ਹੀ ਉਹਤੋਂ ਵੀ ਵਧੀਆ ਭੰਗੜੇ ਦਾ ਪ੍ਰਦਰਸ਼ਨ ਹੋ ਸਕਦਾ ਹੈ ਜਿਵੇਂ ਆਪਾਂ ਸਕੂਲਾਂ ਕਾਲਜਾਂ ਅਤੇ ਫੰਕਸ਼ਨ ਕਰਦੇ ਹਾਂ ਉਹਨਾਂ ਤੋਂ ਵੀ ਵਧੀਆ ਹੋ ਸਕਦਾ ਹੈ ਜਿਵੇਂ ਕਾਲਜ 'ਚ ਵੀ ਫੰਕਸ਼ਨ ਹੁੰਦੇ ਆ ਉਹਤੋਂ ਵੀ ਵਧੀਆ ਕੁੜੀਆਂ ਮੁੰਡੇ ਇਕੱਠੇ ਹੋ ਕੇ ਭੰਗੜਾ ਪਾ ਸਕਦੇ ਹਨ ਧੰਨਵਾਦ